ਸਤਿ ਸ਼੍ਰੀ ਅਕਾਲ ਮੈਂ ਭੂਲ ਚੱਕ ਢੇਸੀਆਂ ਤੋਂ ਹਰਪ੍ਰੀਤ ਕੌਰ ਬੋਲਦੀ ਪਈ ਹਾਂ ਮੈਨੂੰ ਅੰਮ੍ਰਿਤਸਰ ਵਿੱਚ ਬਹੁਤ ਜ਼ਰੂਰੀ ਕੰਮ ਹੈ ਉੱਥੇ ਮੇਰੇ ਚਾਚਾ ਜੀ ਰਹਿੰਦੇ ਹਨ ਅਤੇ ਉਹ ਬਹੁਤ ਬਿਮਾਰ ਸਨ ਅਤੇ ਮੈਨੂੰ ਅੰਮ੍ਰਿਤਸਰ ਜਾਣ ਲਈ ਇੱਕ ਕੈਬ ਚਾਹੀਦੀ ਹੈ ਕੈਬ ਮੈਨੂੰ ਪੱਚੀ ਮਈ ਦੋ ਹਜ਼ਾਰ ਚੌਵੀ ਨੂੰ ਸਵੇਰੇ ਸੱਤ ਵਜੇ ਨਾਲ ਚਾਹੀਦੀ ਹੈ ਅਤੇ ਮੇਰਾ ਘਰ ਭੂਲ ਚੱਕ ਢੇਸੀਆਂ ਡਿਸਟ੍ਰਿਕਟ ਪਠਾਨਕੋਟ ਪੋਸਟ ਔਫਿਸ ਫਿਰੋਜ਼ਪੁਰ ਕਲਾਂ ਦੇ ਨੇੜੇ ਹੈ ਕੈਬ ਸਵੇਰੇ ਪੂਰੇ ਸੱਤ ਵਜੇ ਮੇਰੇ ਘਰ ਪਹੁੰਚ ਜਾਵੇ ਤਾਂ ਜੋ ਮੈਂ ਚਾਚਾ ਜੀ ਤੋਂ ਜਲਦੀ ਪਹੁੰਚ ਕੇ ਉਹਨਾਂ ਦੀ ਦੇਖਭਾਲ ਕਰ ਸਕਾਂ ਧੰਨਵਾਦ